ਭੰਗੜਾ ਐਰੋਬਿਕਸ ਦੇ ਬਹੁਤ ਸਾਰੇ ਫਾਇਦੇ ਹਨ ਭੰਗੜਾ ਐਰੋਬਿਕਸ ਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਇਸਦੇ ਨਾਲ ਅਸੀਂ ਆਪਣੇ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਕਰ ਸਕਦੇ ਇਹ ਮਨੋਰੰਜਨ ਦੇ ਨਾਲ ਨਾਲ ਇੱਕ ਸਿਹਤਮੰਦ ਐਕਸਾਈਜ਼ ਵੀ ਹੈਗੀ ਰਵਾਇਤੀ ਪੰਜਾਬੀ ਸੰਗੀਤ ਅਤੇ ਡਾਂਸ ਦੀ ਵਰਤੋਂ ਨਾਲ ਇਸ ਨੂੰ ਹੋਰ ਦਿਲਚਸਪ ਬਣਾਇਆ ਜਾ ਸਕਦਾ ਹੈ ਭੰਗੜਾ ਪੰਜਾਬ ਦੀ ਟਰਡੀਸ਼ਨਲ ਡਾਂਸ ਕਿਸਮ ਹੈ ਇਸ ਵਿੱਚ ਫੁੱਲ ਬਾਡੀ ਮੂਵਮੈਂਟ ਡਾਂਸ ਅਤੇ ਆਪਣੀ ਫੁਟਬਕ ਸਭ ਤੋਂ ਅਹਿਮ ਹਨ ਉਹ ਕੋਈ ਖੁਸ਼ੀ ਦਾ ਮੌਕਾ ਨਹੀਂ ਜਿੱਥੇ ਭੰਗੜਾ ਦਿਲਚਸਪ ਨਹੀਂ ਬਣਾਉਂਦਾ ਢੋਲ ਦੀਆਂ ਬੀਟਸ ਅਤੇ ਹੋਣ ਵਾਲੇ ਭੰਗੜੇ ਨਾਲ ਸਰੀਰ ਦੇ ਲਚੀਲਾ ਅਤੇ ਉਸ ਲਚੀਲਾਪਨ ਆਉਂਦਾ ਸਰੀਰ ਦੇ ਵਿੱਚ ਲਚੀਲਾਪਨ ਆਉਂਦਾ ਹੈ ਅਤੇ ਰਵਾਇਤੀ ਪੰਜਾਬੀ ਸੰਗੀਤ ਦੇ ਡਾਂਸ ਦੀ ਵਰਤੋਂ ਨਾਲ ਕਰਕੇ ਅਸੀਂ ਇਸ ਨੂੰ ਹੋਰ ਦਿਲਚਸਪ ਬਣਾ ਬਣਾਉਂਦੇ ਹਾਂ ਇਸ ਵਿੱਚ ਸਾਡੇ ਮੰਨੋਰੰਜਨ ਵੀ ਹੁੰਦਾ ਹੈ ਸਾਡਾ ਦਿਲ ਲੱਗਾ ਰਹਿੰਦਾ ਹੈ ਅਸੀਂ ਇਸ ਤੋਂ ਬੋਰ ਨਹੀਂ ਹੁੰਦੇ

ਭੰਗੜੇ ਢੋਲ 'ਤੇ ਫਿਰ ਕਦੇ ਹੀ ਮਸਤੀ ਅਤੇ ਉਤਸਾਹ ਪੂਰਾ ਚਰਮ ਦਾ ਹੋ ਜਾਂਦਾ ਹੈ ਧੰਨਵਾਦ